ਜਦੋਂ ਕਾਗਜ਼ ਦੀ ਇੱਕ ਖਾਲੀ ਸ਼ੀਟ ਚੁੱਕਦੇ ਹਾਂ ਅਤੇ ਡਰਾਇੰਗ ਸ਼ੁਰੂ ਕਰਦੇ ਹਾਂ ਤਾਂ ਉਹ ਕਲਪਨਾ ਦੇ ਸੰਸਾਰ ਵਿੱਚ ਦਾਖਲ ਹੁੰਦੇ ਹੈ ਵਿਵਹਾਰਿਕ ਉਦਾਹਰਨ ਆਪਣੇ ਬੱਚੇ ਨੂੰ ਇੱਕ ਸ਼ਾਨਦਾਰ ਜੀਵ ਜਾਂ ਇੱਕ ਕਾਲਪਨਿਕ ਸੰਸਾਰ ਬਣਾਉਣ ਲਈ ਉਤਸਾਹਿਤ ਕਰੋ ਇਹ ਅਭਿਆਸ ਉਹਨਾਂ ਨੂੰ ਆਪਣੀ ਰਚਨਾਤਮਕ ਮੁਖਤਾਰ ਨੂੰ ਸੁਤੰਤਰ ਰੂਪ ਵਿੱਚ ਖੋਜਣ ਦੀ ਆਗਿਆ ਹੈ